ਅਤੇ ਸਬਜ਼ੀ ਮੰਨ ਲਉ ਮੰਨ ਲਉ ਤੁਸੀਂ ਜਿਹਨੂੰ ਆਪਾਂ ਟੈਮ ਤੋਂ ਪਹਿਲਾਂ ਪਹੁੰਚਾ ਦੇਈਏ ਤਾਂ ਸਾਨੂੰ ਇਨਾਮ ਵੀ ਮਿਲਦੇ ਹਨ ਅਤੇ ਫਿਰ ਵੀ ਭਾਰਤ ਵਿੱਚ ਘੁੰਮਣ ਨੂੰ ਬਹੁਤ ਵਧੀਆ ਚੀਜ਼ਾਂ ਨੇ ਜਿੱਦਾਂ ਕਿ ਗੋਲਡਨ ਟੈਂਪਲ ਕੋਈ ਹੋਰ ਅੰਬਰਸਰ 'ਚ ਕਾਫੀ ਮੰਦਰ ਰਹਿਣਾ ਸਹਿਣਾ ਕਾਫੀ ਵਧੀਆ ਆ ਹੋਰ ਵੀ ਕਈ ਘੁੰਮਣ ਫਿਰਨ ਨੂੰ ਬਹੁਤ ਵਧੀਆ ਮੰਦਰ ਨੇ ਖਾਣਾ ਪੀਣਾ ਸਹੀ ਆ ਰੈਸਟੋਰੈਂਟਸ 'ਚ ਜਿੰਨੇ ਤੁਸੀਂ ਪੈਸੇ ਜ਼ਿਆਦਾ ਲਾਉਂਗੇ ਓਨਾ ਵਧੀਆ ਮਿਲਦਾ ਰਹਿਣਾ ਸਹਿਣਾ ਵੀ ਉਹਦੇ ਵਿੱਚ ਜਿਹੜਾ ਆਪਣਾ ਸਮਾਨ ਹੁੰਦਾ ਉਹਦੀ ਵੀ ਜਾਣੀ ਕਿ ਰਖਵਾਲੀ ਵਧੀਆ ਕਰਦੇ ਨੇ ਅਤੇ ਖਾਣਾ ਪੀਣਾ ਹੋਟਲਾਂ 'ਚ ਇੰਨਾ ਵਧੀਆ ਹੁੰਦਾ ਨਾ ਹਾਂਜੀ ਹੋਰ ਵੀ ਕਈ ਚੀਜ਼ਾਂ ਨੇ ਜਿੱਦਾਂ ਕਿ ਹਨੂਮਾਨ ਦਾ ਮੰਦਰ ਉੱਥੇ ਐਨ ਵਧੀਆ ਆ ਲੰਗਰ ਲੁੰਗਰ ਵਧੀਆ ਹੈ